ਬੋਲ ਰਿਹਾ ਜੀ ਜੀ ਸਰ ਬੋਲ ਰਿਹਾਂ ਜੀ ਤੁਸੀਂ ਕੌਣ ਜੀ ਸਰ ਜੀ ਜੀ ਸਾਨੂੰ ਰਿਕੁਾਇਰਮੈਂਟ ਹੈ ਉਸ ਦੇ ਲਈ ਅਸੀਂ ਇਸ਼ਤਿਹਾਰ ਦਿੱਤਾ ਸੀ ਅਖਬਾਰ 'ਚ

ਹਾਂਜੀ ਤੁਸੀਂ ਠੀਕ ਹੈ ਤੁਸੀਂ ਤੁਹਾਡੀ ਬੇਸਿਕ ਕੁਆਲੀਫਿਕੇਸ਼ਨ ਸਰ ਕੀ ਹੈ ਬੀ ਬੀ ਐਡ ਦੀ ਕਿਹੜੇ ਜੀ ਸਰ ਬੀ ਐਡ ਦੇ ਕਿਹੜੇ ਸਬਜੈਕਟ ਨੇ ਜੀ ਤੁਹਾਡੇ ਠੀਕ ਹੈ ਸਾਨੂੰ ਠੀਕ ਹੈ ਜੀ ਤੁਹਾਨੂੰ ਤੁਹਾਡੀ ਜਿਹੜੀ ਬੀ ਐਡ ਦੀ ਡਿਗਰੀ ਹੈ ਉਹ ਕਿਸ ਸੰਸਥਾ ਤੋਂ ਹੈ ਜੀ ਕਿਸ ਯੂਨੀਵਰਸਿਟੀ ਤੋਂ ਹੈ ਠੀਕ ਹੈ ਜੀ ਸਰ ਸਾਡੇ ਕੋਲ ਐਸ ਐਸ ਟੀ ਪਲੱਸ ਪੰਜਾਬੀ ਦੋਨਾਂ ਸਬਜੈਕਟ ਦੀ ਸਾਨੂੰ ਟੀਚਰ ਦੀ ਰਿਕੁਾਇਰਮੈਂਟ ਹੈ ਕੀ ਤੁਸੀਂ ਦੋਨੋਂ ਸਬਜੈਕਟ ਇਕੱਠੇ ਪੜ੍ਹਾ ਸਕਦੇ ਹੋ ਉਹ ਕਿਸ ਸੰਸਥਾ ਦਾ ਜੀ ਉੱਥੇ ਤੁਸੀਂ ਕਿਹੜਾ ਸਬਜੈਕਟ ਟੀਚ ਕੀਤਾ ਜੀ ਠੀਕ ਹੈ ਉੱਥੋਂ ਦੇ ਤੁਹਾਡੇ ਰਿਜਲਟਸ ਹੋਣਗੇ ਠੀਕ ਹੈ ਜੀ ਤੁਹਾਨੂੰ ਤੁਸੀਂ ਇੱਥੇ ਸਾਡੇ ਕੋਲ ਐਸ ਐਸ ਅਤੇ ਪੰਜਾਬੀ ਦੋਨੇ ਸਬਜੈਕਟ ਦੇਖੋ ਕਰਵਾਉਣੇ ਆ ਸਾਨੂੰ ਹਾਈ ਸਕੂਲ ਤੱਕ ਦਸਵੀਂ ਕਲਾਸ ਤੱਕ ਦੇ ਸਾਨੂੰ ਟੀਚਰਸ ਦੀ ਜ਼ਰੂਰਤ ਹੈ ਤੁਸੀਂ ਪੜ੍ਹਾਇਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੀ ਤੁਸੀਂ ਅ ਇਹਨਾਂ ਬੱਚਿਆਂ ਨਾਲ ਕਿਉਂਕਿ ਉਹਨਾਂ ਤੋਂ ਛੋਟੇ ਨੇ ਇਹਨਾਂ ਨਾਲ ਤੁਸੀਂ ਆਪਦੇ ਆਪ ਨੂੰ ਸਹਿਜ ਮਹਿਸੂਸ ਕਰੋਗੇ ਠੀਕ ਹੈ ਠੀਕ ਹੈ ਜੀ ਤੁਸੀਂ ਕੀ ਐਕਸਪੈਕਟ ਕਰਦੇ ਹੋ ਸਾਡੇ ਤੋਂ ਠੀਕ ਹੈ ਜੀ ਦੇਖੋ ਸੰਸਥਾ ਇੰਨੇ ਤਾਂ ਨਹੀਂ ਦੇ ਸਕੇਗੀ ਪਰ ਮੈਂ ਫਿਰ ਵੀ ਤੁਹਾਡੀ ਕੁਆਲੀਫਿਕੇਸ਼ਨ ਅਤੇ ਤੁਹਾਡੇ ਤਜ਼ਰਬੇ ਦੇ ਆਧਾਰ ਦੇ ਉੱਪਰ ਤੁਹਾਨੂੰ ਪਰਸਨਲੀ ਵਿਜਿਟ ਕਰਨ ਲਈ ਜ਼ਰੂਰ ਕਹਾਂਗਾ ਤੁਸੀਂ ਹੰ ਜਦੋਂ ਵੀ ਜਲਦੀ ਹੋ ਸਕਦਾ ਕੱਲ੍ਹ ਨੂੰ ਆਪਣੇ ਸਾਰੇ ਦਸਤੇਵ ਦਸਤਾਵੇਜ਼ਾਂ ਸਮੇਤ ਸਕੂਲ ਦੇ ਵਿੱਚ ਆ ਕੇ ਮੈਨੂੰ ਮਿਲੋ

ਜੀ ਵੈਲਕਮ ਸਵੇਰੇ ਸੁਬਹਾ ਆ ਕੇ ਤੁਸੀਂ ਕਾਊਂਟਰ ਦੇ ਉੱਪਰ ਦੱਸ ਦੇਣਾ ਕਿ ਤੁਹਾਡੀ ਅਪੁਆਇੰਟਮੈਂਟ ਹੈ ਅਤੇ ਸਹੀ ਸਾਢੇ ਨੌ ਵਜੇ ਤੁਸੀਂ ਮੇਰੇ ਕੋਲ ਪਹੁੰਚ ਜਾਣਾ ਵੈਲਕਮ ਸਰ